ਸਕੂਲ ਟਾਈਮ ਵਿੱਚ ਮੈਂ ਇੱਕ ਨਾਵਲ ਪੜ੍ਹਿਆ ਸੀ ਜਿਸ ਦਾ ਨਾਮ ਸੀ ਪਹੁ ਫੁਟਾਲੇ ਤੋਂ ਪਹਿਲਾਂ ਹਾਂ ਇਹ ਨਾਵਲ ਮੈਨੂੰ ਸੋਚਣ ਉਕਸਾਉਣ ਵਾਲੀ ਲੱਗੀ ਹੈ ਕਿਉਂਕਿ ਇਸ ਦੇ ਵਿੱਚ ਸਾਡੀ ਆਜ਼ਾਦੀ ਬਾਰੇ ਅਤੇ ਜਿਹੜੇ ਲੋਕਾਂ ਨੇ ਸੰਘਰਸ਼ ਕੀਤੇ ਉਸ ਬਾਰੇ ਬਹੁਤ ਜ਼ਿਆਦਾ ਕੁਛ ਲਿਖਿਆ ਹੋਇਆ ਸੀ